ਅਸੀਂ ਕਿਤਾਬਾਂ ਛੋਟੇ ਹੁੰਦੇ ਤੋਂ ਹੀ ਆਪਣੇ ਬੁੱਕ ਸਟੋਰਾਂ ਤੋਂ ਖਰੀਦਦੇ ਆ ਰਹੇ ਐਂ ਛੋਟੀਆਂ ਕਲਾਸਾਂ ਤੋਂ ਅੱਜ ਗ੍ਰੈਜੂਏਟ ਵੀ ਹੋ ਗਏ ਹੁਣ ਵੀ ਅੱਧ ਮੁੱਲ ਦੀਆਂ ਕਿਤਾਬਾਂ ਬੁੱਕ ਸਟੋਰ ਤੋਂ ਹੀ ਖਰੀਦਦੇ ਹਾਂ ਇਹਦੇ ਵਿੱਚ ਫਾਇਦਾ ਹੀ ਆ ਇੱਕ ਤਾਂ ਬੁੱਕ ਦੀ ਮਾਊਂਟ ਹੈ ਜੋ ਕੀਮਤ ਦੋ ਸੌ ਰੁਪਏ ਹੁੰਦੀ ਏ ਉਹ ਆਪਾਂ ਨੂੰ ਸੌ ਜਾਂ ਇੱਕ ਸੌ ਵੀਹ ਤੀਹ ਰੁਪਏ ਦੇ ਵਿੱਚ ਮਿਲ ਜਾਂਦੀ ਏ ਇਹਦੀ ਫਾਇਦੇ ਵਾਲੀ ਗੱਲ ਆ ਅਤੇ ਸਾਡੇ ਨੇੜੇ ਬਹੁਤ ਬੁੱਕ ਸਟੋਰ ਹੈਗੇ ਨੇ ਸੈਕਿੰਡ ਹੈਂਡ ਬ ਕਿਤਾਬਾਂ ਜਿੱਥੋਂ ਮਿਲਦੀਆਂ ਨੇ ਹੋਰ ਵੀ ਕਲਾਸ ਬੜੇ ਦੋਸਤ ਵੀ ਤਕਰੀਬਨ ਸਾਰੇ ਸੈਕਿੰਡ ਹੈਂਡ ਕਿਤਾਬਾਂ ਹੀ ਖਰੀਦਦੇ ਨੇ ਸੈਕਿੰਡ ਹੈਂਡ ਕਿਤਾਬਾਂ ਖਰੀਦਣ ਦੇ ਨਾਲ ਫਾਇਦਾ ਹੀ ਰਹਿੰਦਾ ਅਤੇ ਹੋਰ ਆਪਣੇ ਨੇੜੇ ਵੀ ਦੂਰ ਵੀ ਕਾਫੀ ਬੁੱਕ ਸਟੋਰ ਬਹੁਤ ਨੇ ਜਿਨਾਂ ਨੂੰ ਬੁੱਕ ਸਟੋਰ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਰਹਿੰਦਾ ਜਿਹੜੇ ਕਿ ਆਪਣੇ ਬੁੱਕ ਦੇ ਵਿੱਚੋਂ ਹੀ ਪੈਸੇ ਤੋਂ ਪੈਸਾ ਕਮਾਉਂਦੇ ਨੇ